ਹੈਲੋ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਮੈਂ ਨਾ ਆਪਣੇ ਡਰਾਈਵ ਲਾਇਸੰਸ ਦੇ ਉੱਪਰ ਆਪਣਾ ਪਤਾ ਚੇਂਜ ਕਰਵਾਉਣਾ ਸੀਗਾ ਮੈਮ ਥੋੜ੍ਹੇ ਦਿਨ ਹੀ ਹੋਏ ਆ ਜੀ ਮੈਂ ਆਪਣਾ ਨਾ ਅਡਰੈਂਸ ਚੇਂਜ ਕੀਤਾ ਮੈਂ ਪਹਿਲਾਂ ਵੀ ਕਿਸੇ ਹੋਰ ਸ਼ਹਿਰ ਰਹਿੰਦਾ ਸੀਗਾ ਅਤੇ ਹੁਣ ਕਿਸੇ ਹੋਰ ਸ਼ਹਿਰ ਹਾਂ ਅਤੇ ਫਿਰ ਮੈਂ ਆਪਣਾ ਡਰਾਈਵਿੰਗ ਲਾਇਸੰਸ 'ਤੇ ਵੀ ਆਪਣਾ ਪਤਾ ਚੇਂਜ ਕਰਵਾਉਣਾ ਸੀਗਾ ਅਤੇ ਹਾਂਜੀ ਹਾਂਜੀ ਆਨਲਾਈਨ ਕਰਵਾ ਦੋ ਬਹੁਤ ਵਧੀਆ ਰਹਿ ਜੇਗਾ ਹਾਂਜੀ ਅਤੇ ਉਹ ਵੀਰ ਜੀ ਔਨ ਨਹੀਂ ਹੋ ਰਿਹਾ ਜੀ ਠੀਕ ਜੀ ਠੀਕ ਠੀਕ ਵੀਰ ਜੀ ਹਾਂਜੀ ਜੀ ਮੈਂ ਇੱਕ ਵਾਰੀ ਵੀ ਕੋਸ਼ਿਸ਼ ਕਰਕੇ ਦੇਖ ਰਹੀ ਹਾਂ ਅਤੇ ਫਿਰ ਮੈਂ ਤੁਹਾਨੂੰ ਦੱਸਦਾ ਹਾਂਜੀ ਹਾਂਜੀ ਆਨਲਾਈਨ ਹੋ ਜੇ ਤਾਂ ਬਹੁਤ ਵਧੀਆ ਰਹਿ ਜੇ ਹਾਂਜੀ ਠੀਕ ਠੀਕ ਹੈ ਜੀ ਹਾਂਜੀ ਆਹ ਓਪਨ ਵੀ ਕਰ ਰਹੇ ਹਾਂ ਓਪਨ ਹੋ ਨਹੀਂ ਰਿਹਾ ਵੀ ਆਪਣੇ ਵੱਲੋਂ ਵੀ ਮੈਂ ਵੀ ਕੋਸ਼ਿਸ਼ ਕਰਕੇ ਵੇਖਦਾ ਵੀ ਜੇ ਉੱਪਰ ਨਾ ਹੋ ਜਾਵੇ ਹਾਂਜੀ ਹਾਂਜੀ ਜੇ ਹੋ ਗਿਆ ਤਾਂ ਬਹੁਤ ਵਧੀਆ ਵੀ ਜੇ ਨਾ ਹੋਇਆ ਤਾਂ ਫਿਰ ਮੈਂ ਤੁਹਾਨੂੰ ਵੀ ਕਾਲ ਕਰਕੇ ਵੀ ਦੱਸਦਾ ਹਾਂਜੀ ਤੁਸੀਂ ਮੈਨੂੰ ਆਪਣਾ ਫੋਨ ਨੰਬਰ ਦੇ ਦਿਆ ਹਾਂਜੀ ਫਿਰ ਮੈਂ ਵੀ ਦੱਸਦਾ ਤੁਹਾਨੂੰ ਵੀ ਕਿਸ ਤਰ੍ਹਾਂ ਕੀ ਹਿਸਾਬ ਹੈ ਹਾਂਜੀ ਹਾਂਜੀ ਹਾਂਜੀ ਬਹੁਤ ਮਿਹਰਬਾਨੀ ਹੋਵੇਗੀ ਤੁਹਾਡੀ ਧੰ ਧੰਨਵਾਦ ਜੀ ਧੰਨਵਾਦ